ਕਿਸਾਨ ਨੂੰ ਝੋਨਾ ਫ਼ਸਲ ਵੇਚਣੀ ਚਾਹੀਦੀ ਹੈ ਮਾਰਕਿਟ ਉਹ ਜਗ੍ਹਾ ਹੈ ਜਿੱਥੇ ਵਪਾਰੀ ਵਪਾਰ ਕਰਦੇ ਹਨ ਆਪਣੀ ਚੀਜ਼ ਵੇਚਦੇ ਹਨ ਸਹੀ ਦਾਮ 'ਤੇ ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਮੁਨਾਫ਼ਾ ਹੋਵੇ ਵੈਸੇ ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਸਰਕਾਰੀ ਤੌਰ 'ਤੇ ਹੀ ਵੇਚਣੀ ਚਾਹੀਦੀ ਹੈ ਕਿਉਂਕਿ ਝੋਨੇ ਦੀ ਕੀਮਤ ਉਹ ਐਮ ਐਸ ਪੀ ਰਾਹੀਂ ਦਿੰਦੇ ਹਨ ਜੋ ਕਿ ਬਾਈ ਰੁਪਏ ਕਿੱਲੋ ਘੱਟੋ ਘੱਟ ਹੈ ਅਤੇ ਅਗਰ ਉਹ ਆਪਣੀ ਫ਼ਸਲ ਵਿਚੋਲੇ ਨੂੰ ਵਿਚੋਲੇ ਵਪਾਰੀ ਨੂੰ ਵੇਚਦੇ ਹਨ ਤਾਂ ਉਹ ਸੋਲਾਂ ਤੋਂ ਅਠਾਰਾਂ ਕਿੱਲੋ ਹੀ ਖਰੀਦ ਦਾ ਹੈ ਇਸ ਲਈ ਵਧੀਆ ਵਿਕਲਪ ਸਰਕਾਰੀ ਹੈ ਕਿਉਂਕਿ ਕਿਉਂਕਿ ਸਰਕਾਰ ਫਸਲਾਂ ਦੇ ਸਹੀ ਦਾਮ ਦਿੰਦੇ ਹਨ ਪਰ ਅਗਰ ਕਿਸੇ ਨੂੰ ਅਗਰ ਕਿਸੇ ਕਿਸਾਨ ਨੂੰ ਜ਼ਿਆਦਾ ਹੀ ਜ਼ਰੂਰਤ ਹੈ ਤਾਂ ਉਹ ਵਿਚੋਲੇ ਵਪਾਰੀ ਨੂੰ ਵੀ ਵੇਚ ਸਕਦਾ ਹੈ